ਪੰਜਾਬੀ ਭਾਸ਼ਾ ਪੰਜਾਬ ਦੀ ਮਾਤ ਭਾਸ਼ਾ ਹੈ ਪੰਜਾਬੀ ਭਾਸ਼ਾ ਵਿੱਚ ਹੀ ਸਭ ਤੋਂ ਪਹਿਲਾਂ ਬੱਚਾ ਆਪਣੀ ਮਾਂ ਤੋਂ ਪੰਜਾਬੀ ਭਾਸ਼ਾ ਵਿੱਚ ਹੀ ਸਿੱਖਦਾ ਹੈ ਪੰਜਾਬ ਵਿੱਚ ਬਹੁਤ ਸਾਰੇ ਲੋਕ ਪੰਜਾਬੀ ਬੋਲਦੇ ਹਨ ਪਰ ਪੰਜਾਬ ਤੋਂ ਬਾਹਰ ਹਿੰਦੀ ਭਾਸ਼ਾ ਦਾ ਇਸਤੇਮਾਲ ਜ਼ਿਆਦਾ ਕੀਤਾ ਜਾਂਦਾ ਹੈ ਜਿਵੇਂ ਕਿ ਅਸੀਂ ਜਾਣਦੇ ਹੀ ਹਾਂ ਕਿ ਭਾਰਤ ਦੀ ਰਾ ਭਾਰਤ ਦੀ ਭਾਸ਼ਾ ਪਹਿਲੀ ਭਾਸ਼ਾ ਹਿੰਦੀ ਹੈ ਅਤੇ ਪੰਜਾਬ ਦੀ ਦੂਜੀ ਭਾਸ਼ਾ ਹਿੰਦੀ ਹੈ ਹਿੰਦੀ ਭਾਸ਼ਾ ਦੀ ਤੁਲਨਾ ਜੇਕਰ ਅਸੀਂ ਪੰਜਾਬੀ ਭਾਸ਼ਾ ਨਾਲ ਕਰੀਏ ਤਾਂ ਇਹ ਬੋਲਣ ਵਿੱਚ ਤਾਂ ਥੋੜ੍ਹਾ ਬਹੁਤ ਮੇਲ ਖਾਂਦੀਆ ਹਨ ਪਰ ਇਹ ਲਿਖਣ ਵਿੱਚ ਬਿਲਕੁਲ ਵੀ ਮੇਲ ਨਹੀਂ ਖਾਂਦੀਆ ਉਹਨਾਂ ਦੇ ਅੱਖਰਾਂ ਦੀ ਬਣਤਰ ਅਲੱਗ ਹੁੰਦੀ ਹੈ ਮੈਂ ਜਿਵੇਂ ਕਿ ਮੈਂ ਸਕੂਲ ਵਿੱਚ ਪੜ੍ਹਦੀ ਹਾਂ ਤਾਂ ਮੈਂ ਦੇਖਦੀ ਹਾਂ ਕਿ ਕੁਛ ਕੁ ਬੰ ਬੱਚੇ ਹਿੰਦੀ ਦਾ ਪ੍ਰਯੋਗ ਕਰਦੇ ਹਨ ਅਤੇ ਕੁਛ ਕੁ ਬੱਚੇ ਪੰਜਾਬੀ ਭਾਸ਼ਾ ਦਾ ਪ੍ਰਯੋਗ ਕਰਦੇ ਹਨ ਪਰ ਸਾਨੂੰ ਗੱਲ ਕਰਕੇ ਇੱਦ ਇੱਦਾਂ ਲੱਗਦਾ ਹੈ ਕਿ ਅਸੀਂ ਇੱਕੋ ਹੀ ਭਾਸ਼ਾ ਵਿੱਚ ਗੱਲ ਕਰ ਰਹੇ ਹੋਈਏ ਪੰਜਾਬੀ ਭਾਸ਼ਾ ਦੇ ਲਈ ਮੈਂ ਹਿੰਦੀ ਭਾਸ਼ਾ ਨਾਲ ਮੇਲ ਖਾਣ ਲਈ ਇਹ ਹੀ ਕਹਾਂਗੀ ਕਿ ਦੋਨੋਂ ਭਾਸ਼ਾਵਾਂ ਹੀ ਸਾਡੀਆਂ ਮਾਤ ਭਾਸ਼ਾਵਾਂ ਹਨ ਇਸ ਲਈ ਅਸ ਇਸ ਇਹਨਾਂ ਭਾਸ਼ਾ ਦੀ ਸਾਨੂੰ ਇੱਜ਼ਤ ਕਰਨੀ ਚਾਹੀਦੀ ਹੈ